ਵੈਸੇ ਤਾਂ ਅੱਜ ਕੱਲ੍ਹ ਹਰ ਇੱਕ ਕੋਲ ਸਮਾਰਟਫੋਨ ਹੈ ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਸਮਾਰਟਫੋਨ ਤਾਂ ਮਿਲੇਗਾ ਹੀ ਮਿਲੇਗਾ ਭਾਵੇਂ ਬੱਚੇ ਤੋਂ ਬੱਚਾ ਕਿਉਂ ਨਾ ਹੋਵੇ ਭਾਵੇਂ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਹਰ ਕੋਈ ਇਸ ਦੀ ਵਰਤੋਂ ਕਰਦਾ ਪਿਆ ਹਰ ਕੋਈ ਇੱਕ ਕੋਲ ਸਮਾਰਟਫੋਨ ਹੈ ਸਮਾਟਫੋਨ ਦੇ ਵਿੱਚ ਅਜਿਹੀਆਂ ਐਪਲੀਕੇਸ਼ਨਸ ਨੇ ਜਿਹਨਾਂ ਦੀ ਅਸੀਂ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਜਿਵੇਂ ਇੰਸਟਾਗ੍ਰਾਮ ਹੋ ਗਿਆ ਵਟਸਐਪ ਥਰੈਡ ਯੂਟਿਊਬ ਟਵਿੱਟਰ ਲਿੰਕਡਇੰਨ ਇਹਨਾਂ ਦੇ ਬਹੁਤ ਸਾਰੇ ਫਾਇਦੇ ਵੀ ਨੇ ਅਤੇ ਨੁਕਸਾਨ ਵੀ ਨੇ ਪਹਿਲੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਐਪਲੀਕੇਸ਼ਨਸ ਦੀ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਫਾਇਦੇ ਵੀ ਨੇ ਅਤੇ ਨੁਕਸਾਨ ਵੀ ਨੇ ਫਾਇਦੇ ਇਹ ਨੇ ਕਿ ਕਾਫੀ ਸਾਰੇ ਬੱਚੇ ਇਹਦੇ ਥਰੂ ਪੈਸੇ ਵੀ ਕਮਾ ਰਹੇ ਨੇ ਭਾਵੇਂ ਉਹ ਰੀਲਸ ਬਣਾ ਕੇ ਕਮਾਣਡੇ ਹੋਣ ਭਾਵੇਂ ਪੋਸਟ ਡਾਲ ਕੇ ਬਹੁਤ ਜ਼ਿਆਦਾ ਬੱਚੇ ਇਹਦੀ ਵਰਤੋਂ ਵੀ ਕਰਦੇ ਨੇ ਜਿਹਦੇ ਕਰਕੇ ਸਾਡਾ ਨੁਕਸਾਨ ਵੀ ਹੁੰਦਾ ਪਿਆ ਹੈ ਕਾਫੀ ਸਾਰੇ ਬੱਚੇ ਭਟਕ ਵੀ ਜਾਂਦੇ ਨੇ ਕਾਫੀ ਸਾਰੇ ਬੱਚੇ ਗਲਤੀਆਂ ਵੀ ਕਰਦੇ ਨੇ ਪਰ ਕਾਫੀ ਸਾਰੇ ਬੱਚੇ ਇਸ ਦੀ ਵਰਤੋਂ ਕਰਕੇ ਆਪਣੇ ਦਿਮਾਗੀ ਸ਼ਕਤੀ ਨੂੰ ਘੱਟ ਵੀ ਕਰ ਰਹੇ ਨੇ ਵੈਸੇ ਤਾਂ ਇਸ ਤੇ ਫਾਇਦੇ ਵੀ ਨੇ ਕਿ ਸਮਾਰਟਫੋਨ ਅੱਜ ਦੀ ਟਾਈਮ 'ਚ ਸਾਡੇ ਲਈ ਬਹੁਤ ਜ਼ਿਆਦਾ ਉਪਯੋਗਤਾਈ ਹੋ ਗਿਆ ਹੈ ਸਾਡਾ ਡਾਟਾ ਹੋਵੇ ਜਾਂ ਇੰਟਰਨੈਟ ਕਿਉਂ ਨਾ ਹੋਵੇ ਇਸ ਦੀ ਵਰਤੋਂ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ ਪਰ ਇਸ ਦੇ ਵਿੱਚ ਹੀ ਸਾਡਾ ਡਾਟਾ ਸਟੋਰ ਰਹਿੰਦਾ ਹੈ ਅਤੇ ਸਾਡਾ ਡਾਟਾ ਸੇਫ ਰਹਿੰਦਾ ਹੈ ਜਿਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਇਸ ਲਈ ਸਮਾਰਟਫੋਨ ਦੇ ਫਾਇਦੇ ਅਤੇ ਨੁਕਸਾਨ ਨੂੰ ਰੱਖਦੇ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਦੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਾਨੂੰ ਇਸ ਦੀ ਜਿੰਨੀ ਵਰਤੋਂ ਕਰਦੇ ਹਾਂ ਉਸ ਤੋਂ ਜ਼ਿਆਦਾ ਸਾਨੂੰ ਇਹਦੇ ਨੁਕਸਾਨ ਮਾਲ ਵੀ ਖਿਆਲ ਦੇਣਾ ਚਾਹੀਦਾ ਹੈ ਥੈਂਕ ਯੂ